ਹੈਲੋ ਹਾਂ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਪੁੱਛ ਨਾ ਸੀ ਅੱਜ ਕੱਲ੍ਹ ਖੇਤੀਬਾੜੀ ਦਾ ਕੀ ਚੱਲ ਰਿਹਾ ਅੱਛਾ ਅੱਛਾ ਤਾਂ ਮੈਂ ਤੁਹਾਨੂੰ ਦੱਸਣਾ ਸੀ ਵੀ ਕਿ ਮੈਂ ਵੀ ਰਿਸਰਚ ਕੀਤੀ ਹੈ ਜਿਹਦੇ ਵਿੱਚ ਆਪਾਂ ਘੱਟ ਖਾਦ ਪਾਉਣ ਨਾਲ ਵੀ ਸਾਡਾ ਉਤਪਾਦਨ ਜ਼ਿਆਦਾ ਹੋਏਗਾ ਅਤੇ ਸਾਡਾ ਪ੍ਰੋਫਿਟ ਵੀ ਜ਼ਿਆਦਾ ਹੋਏਗਾ ਜਿਹਦੇ ਨਾਲ ਸਾਨੂੰ ਫਾਇਦਾ ਮਿਲੇਗਾ ਜਿਹਦੇ 'ਚ ਆਪਾਂ ਖਾਦ ਘੱਟ ਪਾਵਾਂਗੇ ਲਾਗਤ ਘੱਟ ਲੱਗੇਗੀ ਅਤੇ ਆਪਾਂ ਫੁਲ ਪੰਜਾਬ ਵਿੱਚ ਉਹਨੂੰ ਮਤਲਬ ਭੇਜ ਸਕਦੇ ਹਾਂ ਅਤੇ ਹਾਂਜੀ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਭਾਅ ਜੀ ਬਹੁਤ ਪ੍ਰੋਫਿਟ ਹੈ ਆਪਾਂ ਬਹੁਤ ਹੀ ਘੱਟ ਫਰਟੀਲਾਈਜ਼ਰ ਪਾਉਂਦੇ ਹਾਂ ਬੜੀ ਘੱਟ ਖਾਦ ਲਾ ਕੇ ਲਾਗਤ ਬਹੁਤ ਹੀ ਘੱਟ ਹੈ ਬਟ ਇਹਦਾ ਜਿਹੜਾ ਸਾਨੂੰ ਮੁਨਾਫਾ ਹੋਣਾ ਉਹ ਬਹੁਤ ਹੋਣਾ ਸਾਨੂੰ ਬਹੁਤ ਲਾਭ ਹੋਏਗਾ ਜਿੱਦਾਂ ਹਰ ਸਾਡੇ ਪੰਜਾਬ ਨੂੰ ਐੱਮ ਐੱਸ ਪੀ ਦਾ ਬਿਲ ਜਿਹੜਾ ਪਾਸ ਹੁੰਦਾ ਹੈ ਇੱਕ ਲੱਖ ਚੌਵੀ ਹਜ਼ਾਰ ਕਰੋੜ ਰੁਪਇਆ ਮਿਲਦਾ ਅਤੇ ਕਿਉਂ ਨਾ ਆਪਾਂ ਘੱਟ ਲਾਗਤ ਵਿੱਚ ਜ਼ਿਆਦਾ ਲਾਭ ਪਾਈਏ ਅਤੇ ਸਾਡਾ ਵੀ ਫਾਇਦਾ ਰਹੇਗਾ ਅਤੇ ਨਾਲ ਦੂਸਰਿਆਂ ਦਾ ਵੀ ਰਹੇਗਾ ਹਾਂਜੀ ਹਾਂਜੀ ਹਾਂਜੀ ਓਕੇ ਬਾਏ